ਸਟੈਂਪ ਸਿੱਕੇ ਜਿਹੜੇ ਆ ਬਹੁਤ ਕੀਮਤੀ ਹਨ ਇਹਨਾਂ ਬਾਰੇ ਸਾਨੂੰ ਪਿਛੋਕੜ ਦਾ ਪਤਾ ਲੱਗਦਾ ਹੈ ਅਤੇ ਪਿਛਲੇ ਸ ਸਾਲਾਂ ਦਾ ਪਤਾ ਲੱਗਦਾ ਹੈ ਬਈ ਕਿਹੜੇ ਸਾਲ ਮਾ ਕਿਹੜੇ ਸਿੱਕੇ 'ਤੇ ਤੇ ਏ ਹੁਣ ਵੀ ਪੁਰਾਣੇ ਦੇਖਣ 'ਤੇ ਪੁਰਾਣੀਆਂ ਚੀਜ਼ਾਂ ਸਾਨੂੰ ਇਸ ਬਾਰੇ ਪਤਾ ਲੱਗਦਾ ਹੈ